ਸਾਡੇ ਸ਼ਹਿਰ ਵਿੱਚ ਭ੍ਰਿਸ਼ਟਾਚਾਰ ਈਵਨ ਕਿ ਪੂਰੇ ਹਿੰਦੁਸਤਾਨ ਵਿੱਚ ਭ੍ਰਿਸ਼ਟਾਚਾਰ ਬਹੁਤ ਹੀ ਵੱਡੇ ਪੱਧਰ 'ਤੇ ਚੱਲ ਰਿਹਾ ਹੈ ਅਗਰ ਕਿਸੇ ਆਮ ਵਿਅਕਤੀ ਨੂੰ ਵਕੀਲ ਪੁਲਿਸ ਜਾਂ ਪੰਚਾਇਤ ਜਾਂ ਤਹਿਸੀਲ ਦਫਤਰ ਦੇ ਜਿਹੜੇ ਆਗੂ ਹਨ ਜਿਹੜੇ ਉੱਥੇ ਕੰਮ ਕਰਦੇ ਹਨ ਅਗਰ ਉਹਨਾਂ ਨਾਲ ਕੋਈ ਕੰਮ ਪੈ ਜਾਵੇ ਤਾਂ ਇਹ ਆਮ ਗੱਲ ਹੀ ਹੈ ਕਿ ਉਹਨਾਂ ਨੇ ਭ੍ਰਿਸ਼ਟਾਚਾਰ ਦਾ ਅਨੁਭਵ ਕੀਤਾ ਹੋਵੇਗਾ ਮੈਂ ਵੀ ਭ੍ਰਿਸ਼ਟਾਚਾਰ ਦਾ ਅਨੁਭਵ ਕੀਤਾ ਹੈ ਇਹ ਗੱਲ ਹੈ ਦੋ ਸਾਲ ਪਹਿਲਾਂ ਦੀ ਜਦੋਂ ਮੈਂ ਆਪਣੇ ਬੀਕੌਮ ਦੇ ਥਰਡ ਈਅਰ ਵਿੱਚ ਸੀ ਮੈਂ ਆਪਣੇ ਕੋਲੇਜ ਗਿਆ ਅਤੇ ਮੈਂ ਆਪਣੀ ਸਕੂਟੀ 'ਤੇ ਗਿਆ ਮੇਰੀ ਸਕੂਟੀ ਬਾਹਰੋਂ ਚੋਰੀ ਹੋ ਗਈ ਚੋਰੀ ਹੋਣ ਦੇ ਨਾਲ ਹੀ ਮੈਂ ਨਜ਼ਦੀਕੀ ਥਾਣੇ ਵਿੱਚ ਗਿਆ ਅਤੇ ਮੈਂ ਕੰਪਲੇਂਟ ਕੀਤੀ ਕਿ ਮੇਰੀ ਸਕੂਟੀ ਜਿਹੜੀ ਚੋਰੀ ਹੋ ਚੁੱਕੀ ਹੈ ਅਤੇ ਉੱਥੇ ਦੇ ਜਿਹੜੇ ਆਗੂ ਸਨ ਉੱਥੇ ਇੰਸਪੈਕਟਰ ਸਨ ਉਹਨਾਂ ਨੇ ਕਿਹਾ ਕਿ ਆਪ ਜੀ ਕੋਲੋਂ ਅਠਾਰ੍ਹਾਂ ਹਜ਼ਾਰ ਰੁਪਇਆ ਲਿਆ ਜਾਵੇਗਾ ਅਤੇ ਸਕੂਟਰੀ ਆਪ ਜੀ ਨੂੰ ਸ਼ਾਮੀ ਸੱਤ ਵਜੇ ਆਪ ਜੀ ਦੇ ਘਰ ਦੇ ਅੱਗੇ ਖੜ੍ਹਾ ਦਿੱਤੀ ਜਾਵੇਗੀ ਮੈਨੂੰ ਉਸ ਦਿਨ ਸਮਝ ਆਇਆ ਕਿ ਭ੍ਰਿਸ਼ਟਾਚਾਰ ਬਹੁਤ ਹੀ ਵੱਡੇ ਪੱਧਰ 'ਤੇ ਜਾ ਚੁੱਕਾ ਹੈ ਇਹ ਬਹੁਤ ਗਲਤ ਚੀਜ਼ ਹੈ ਸਰਕਾਰ ਨੂੰ ਇਸ ਉੱਪਰ ਸਟ੍ਰਿਕਟ ਐਕਸ਼ਨ ਲੈਣੇ ਚਾਹੀਦੇ ਹਨ ਤਾਂ ਜੋ ਇੱਥੋਂ ਦੇ ਜਿੰਨੇ ਕੰਮ ਹਨ ਉਹ ਬੜੇ ਸਮੂਥਲੀ ਚੱਲਣ ਅਤੇ ਸਾਰੇ ਲੋਕਾਂ ਨੂੰ ਉਹਨਾਂ ਦਾ ਹੱਕ ਮਿਲ ਮਿਲਸ ਮਿਲ ਸਕੇ